ਪੰਜਾਬੀ ਭਾਸ਼ਾ ਆਮ ਲੋਕ ਗਲਤ ਸੋਚਦੇ ਹਨ ਬੋਲਣ ਲਈ ਕਿਉਂਕਿ ਇਹ ਇਹ ਬੋਲਣ ਨਾਲ ਲੋਕ ਸੋਚਦੇ ਹਨ ਕਿ ਪੇਂਡੂ ਲੋਕ ਬੋਲਦੇ ਹਨ ਅਤੇ ਉਹਨਾਂ ਨੂੰ ਬੋਲਣ ਵਿੱਚ ਸ਼ਰਮ ਆਉਂਦੀ ਹੈ ਕਿਉਂਕਿ ਅੱਜ ਕੱਲ੍ਹ ਲੋਕ ਇੰਗਲਿਸ਼ ਬੋਲਦੇ ਉਹਨਾਂ ਨੂੰ ਲੋਕ ਇੰਟੈਲੀਜੈਂਟ ਸਮਝਦੇ ਹੈ ਸਮਝਦੇ ਹੈ ਓਹ ਬਹੁਤ ਜ਼ਿਆਦਾ ਹੀ ਇੰਟੈਲੀਜੈਂਟ ਹਨ ਇਸ ਲਈ ਆਪ ਸਾਨੂੰ ਇਹ ਸਮਝਣਾ ਚਾਹੀਦਾ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਭਾਸ਼ਾ ਹੈ ਇਸ ਲਈ ਸਾਨੂੰ ਉਹ ਭਾਸ਼ਾ ਕਦੇ ਵੀ ਭੁੱਲਣੀ ਨਹੀਂ ਚਾਹੀਦੀ